ਕੱਪੜੇ ਸੀਨਾ ਮੇਰਾ ਸ਼ੌਕ ਹੈ ਮੇਰੇ ਦਾਦੀ ਜੀ ਬਚਪਨ 'ਚ ਜਦੋਂ ਮੈਂ ਦੇਖਿਆ ਉਹ ਕੱਪੜੇ ਸੀਂਦੇ ਸਨ ਮੈਨੂੰ ਵੀ ਉਹਨਾਂ ਨੂੰ ਦੇਖ ਕੇ ਬਹੁਤ ਸ਼ੌਂਕ ਲੱਗਦਾ ਸੀਗਾ ਕਿ ਮੈਂ ਵੀ ਕੱਪੜੇ ਸੀਵਾਂ ਅਤੇ ਉਸ ਤੋਂ ਮੈਂ ਸ਼ਿਕਸ਼ਾ ਲੈ ਕੇ ਇਹ ਸੋਚਿਆ ਕਿ ਮੈਂ ਹੁਣ ਵੱਡੀ ਹੋ ਗਈ ਹਾਂ ਮੈਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਅਤੇ ਮੈਂ ਮੇਰੀ ਇੱਕ ਆਪਣੀ ਬੁਟੀਕ ਹੈ ਮੈਂ ਵੱਖੋ ਵੱਖ ਸੂਟ ਤਿਆਰ ਕਰਦੀ ਹਾਂ ਤਾਂ ਵੱਖੋ ਵੱਖ ਰੇਟ ਹੈ ਮੈਂ ਸਿੰਪਲ ਸੂਟ ਦਾ ਸਿੰਪਲ ਸੂਟ ਦਾ ਚਾਰ ਸੌ ਰੁਪਇਆ ਲੈਂਦੀ ਹਾਂ ਅਤੇ ਅਗਰ ਉੱਤੇ ਲਾਈਨਿੰਗ ਲੱਗਣੀ ਹੋਵੇ ਤਾਂ ਮੈਂ ਅੱਠ ਸੌ ਰੁਪਇਆ ਲੈਂਦੀ ਹਾਂ ਮੈਂ ਪਲਾਜੋ ਸੂਟ ਦਾ ਸਿਕਸ ਹੰਡਰਡ ਲੈਂਦੀ ਹਾਂ ਅਤੇ ਲਾਈਨਿੰਗ ਵਾਲੇ ਦਾ ਪੈਂਟ ਪਲਾਜੋ ਦਾ ਵੀ ਛੇ ਸੌ ਰੁਪਇਆ ਲੈਂਦੀ ਹਾਂ ਸ਼ਰਾਰਾ ਸੂਟ ਦਾ ਸਾਢੇ ਛੇ ਸੌ ਲੈਂਦੀ ਹਾਂ ਮੈਂ ਹਰ ਤਰ੍ਹਾਂ ਦੇ ਕੱਪੜੇ ਸੀਨੀ ਹਾਂ ਇਹ ਕੱਪੜੇ 'ਤੇ ਡਿਪੈਂਡ ਕਰਦਾ ਹੈ ਜਾਂ ਗਾਹਕ 'ਤੇ ਡਿਪੈਂਡ ਕਰਦਾ ਹੈ ਕਿ ਉਹਨੇ ਕਿਹੋ ਜਿਹੇ ਡਿਜ਼ਾਇਨਿੰਗ ਕਰਵਾਉਣੇ ਹੈ ਡਿਜ਼ਾਇਨਿੰਗ ਦੇ ਪੈਸੇ ਮੈਂ ਐਕਸਟਰਾ ਲੈਂਦੀ ਹਾਂ ਮੇਰੇ ਇਲਾਕੇ 'ਚ ਤਾਂ ਸਿੰਪਲ ਸੂਟ ਦੀ ਸਿਲਾਈ ਛੇ ਸੌ ਰੁਪਏ ਲੈਂਦੇ ਹਨ ਅਤੇ ਲੈ ਮੇਰੀ ਬੁਟੀਕ ਅਜੇ ਇੰਨੀ ਮਸ਼ਹੂਰ ਨਹੀਂ ਹੋਈ ਹੈ ਤਾਂ ਕਰਕੇ ਮੈਂ ਥੋੜ੍ਹੇ ਰੇਟ ਘੱਟ ਲੈਂਦੀ ਹਾਂ ਲਾਈਨਿੰਗ ਵਾਲੇ ਸੂਟ ਦੀ ਮੇਰੇ ਇਲਾਕੇ 'ਚ ਬਾਰ੍ਹਾਂ ਸੌ ਰੁਪਏ ਲੈਂਦੇ ਹਨ ਪਲਾਜ਼ੋ ਸੂਟ ਮੇਰੇ ਇਲਾਕੇ 'ਚ ਪੰਦਰ੍ਹਾਂ ਸੌ ਦਾ ਸੀਂਦੇ ਹਨ ਪੈਂਟ ਪਲਾਜ਼ੋ ਵੀ ਪੰਦਰਾਂ ਸੌ ਦਾ ਸੀਂਦੇ ਹਨ ਅਤੇ ਸ਼ਰਾਰਾ ਸੂਟ ਸੌਲ੍ਹਾਂ ਸੌ ਰੁਪਏ ਦਾ ਸੀਂਦੇ ਹਨ ਅਤੇ ਮੈਂ ਚਾਹੁੰਦੀ ਹਾਂ ਕਿ ਮੇਰੀ ਬੁਟੀਕ ਦੀ ਇਸ ਇਸ ਤਰ੍ਹਾਂ ਅੱਛੀ ਤਰ੍ਹਾਂ ਚੱਲੇ ਤਾਂ ਕਿ ਮੈਂ ਅੱਛੇ ਅੱਛੇ ਡਿਜ਼ਾਇਨ ਬਣਾਵਾਂ ਅਤੇ ਅੱਛੀ ਤਰ੍ਹਾਂ ਸੂਟ ਤਿਆਰ ਕਰਾਂ